ਹੈਲੋ ਸਰ ਓਲਾ ਕੰਪਨੀ ਤੋਂ ਬੋਲਦੇ ਸਰ ਅਸੀਂ ਜਗਤਪੁਰੇ ਤੋਂ ਤੁਹਾਡੀ ਕੈਬ ਅਨੰਦਪੁਰ ਸਾਹਿਬ ਜਾਣ ਦੇ ਲਈ ਬੁੱਕ ਕਰਵਾਈ ਸੀ ਸਾਨੂੰ ਡੇਢ ਘੰਟਾ ਹੋ ਗਿਆ ਤੁਹਾਡੀ ਕੈਬ ਦਾ ਇੰਤਜ਼ਾਰ ਕਰਦੇ ਹੋਏ ਜੋ ਕਿ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚੀ ਸਾਡੀ ਪੂਰੀ ਫੈਮਿਲੀ ਅਨੰਦਪੁਰ ਸਾਹਿਬ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਆਨੰਦਪੁਰ ਸਾਹਿਬ ਸਾਰੇ ਗੁਰਦੁਆਰੇ ਦੇਖਣੇ ਸੀ ਅਸੀਂ ਤੁਹਾਡੇ ਸਰਵਿਸ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਪਰ ਤੁਹਾਡੇ ਡਰਾਈਵਰ ਦੇ ਲੇਟ ਆਉਣ ਕਾਰਨ ਅਸੀਂ ਬਹੁਤ ਜ਼ਿਆਦਾ ਨਾ ਖੁਸ਼ ਹਾਂ ਅਗਰ ਤੁਹਾਡਾ ਡਰਾਈਵਰ ਟਾਇਮ ਸਿਰ ਸਾਡੇ ਕੋਲ ਨਹੀਂ ਪਹੁੰਚਿਆ ਅਜੇ ਤੱਕ ਵੀ ਨਹੀਂ ਪਹੁੰਚਿਆ ਤੋ ਸੋ ਅਸੀਂ ਇਸ ਚੀਜ਼ ਤੋਂ ਥੋੜ੍ਹਾ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਦੂਸਰੀ ਕੈਬ ਜਿਹੜੀ ਹੈ ਉਹ ਬੁੱਕ ਕਰਵਾ ਲਈ ਹੈ ਜੋ ਕਿ ਲੋਕਲ ਹੈ ਅਤੇ ਤੁਹਾਡੀ ਕੈਬ ਨਾਲੋਂ ਸਸਤੀ ਵੀ ਹੈ ਅਤੇ ਅਸੀਂ ਸਰ ਤੁਹਾਡੀ ਕੈਬ ਨੂੰ ਰੱਦ ਕਰਨਾ ਕਰਵਾਉਣਾ ਚਾਹੁੰਦੇ ਹਾਂ ਕਿ ਬੇਨਤੀ ਹੈ ਸਰ ਕਿ ਤੁਸੀਂ ਆਪਣੇ ਡਰਾਈਵਰਾਂ ਨੂੰ ਥੋੜ੍ਹਾ ਜਿਹਾ ਡਾਂਟ ਕੇ ਖਿੱਚ ਕੇ ਰੱਖੋ ਤਾਂ ਜੋ ਉਹ ਟਾਈਮ ਦੇ ਪਾਬੰਦ ਰਹਿਣ ਆਪ ਪਾਬੰਦ ਰਹਿਣ ਅਤੇ ਟਾਈਮ ਸਿਰ ਪਹੁੰਚ ਸਕਣ ਆਪਣੀ ਡਿਊਟੀ ਨੂੰ ਟਾਈਮ ਸਿਰ ਨਿਭਾ ਸਕਣ ਅਤੇ ਕੋਈ ਦੂਸਰੇ ਨੂੰ ਖ਼ਰਾਬ ਨਾ ਕਰਨ ਪਲੀਜ਼ ਸਰ ਸੋਰੀ ਐਂਡ ਥੈਂਕ ਯੂ